ਸਾਡੇ ਘਰ ਵਿੱਚ ਤਕਰੀਬਨ ਅੱਠ ਘੰਟੇ ਹੀ ਬਿਜਲੀ ਆਉਂਦੀ ਹੈ ਅਤੇ ਗਰਮੀ ਵਿੱਚ ਬਿਜਲ ਬਿਜਲੀ ਨਾ ਹੋਣਾ ਨਾ ਹੋਣ ਕਾਰਨ ਸਾਡਾ ਬਹੁਤ ਹੀ ਮਾੜਾ ਹਾਲ ਹੁੰਦਾ ਹੈ ਅਸੀਂ ਬਿਜਲੀ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਸਾਡੇ ਫੋਨ ਵੀ ਚਾਰਜ ਨਹੀਂ ਹੁੰਦੇ ਫੋਨ ਵੀ ਜਲਦੀ ਡੈੱਡ ਹੋ ਜਾਂਦੇ ਹਨ ਅਤੇ ਸ ਸ ਸਾਨੂੰ ਪੜ੍ਹਨ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਅਤੇ ਬਿਜਲੀ ਤੋਂ ਬਿਨਾਂ ਅਸੀਂ ਪੜ੍ਹ ਵੀ ਨਹੀਂ ਸਕਦੇ ਹਾਂ ਅਤੇ ਕੋਈ ਵੀ ਕੰਮ ਨਹੀਂ ਕਰ ਸਕਦੇ ਜਦੋਂ ਲਾਈਟ ਨਾ ਹੋਵੇ ਸਾਡਾ ਫਰਿੱਜ਼ ਵਿੱਚ ਰੱਖਿਆ ਹੋਇਆ ਸਮਾਨ ਖਰਾਬ ਹੋ ਜਾਂਦਾ ਹੈ ਅਤੇ ਦੁੱਧ ਵੀ ਫੱਟ ਜਾਂਦਾ ਹੈ ਗਰਮੀ ਕਾਰਨ ਸਾਨੂੰ ਗਰਮੀ ਕਾਰਨ ਸਾਨੂੰ ਬਹੁਤ ਹੀ ਜ਼ਿਆਦਾ ਘਬਰਾਹਟ ਵੀ ਹੁੰਦੀ ਹੈ ਅਤੇ ਅਸੀਂ ਗਰਮੀ ਵਿੱਚ ਵਾਰ ਵਾਰ ਨਹਾਉਂਦੇ ਹਾਂ ਅਤੇ ਬਰਸਾਤ ਦੇ ਦਿਨਾਂ ਵਿੱਚ ਜਦੋਂ ਲਾਈਟ ਚਲੀ ਜਾਵੇ ਤਾਂ ਸ ਤਾਂ ਗਰਮੀ ਤਾਂ ਲੱਗਦੀ ਹੈ ਅਤੇ ਨਾਲ ਦੀ ਨਾਲ ਸਾਨੂੰ ਨਾਲ ਹੀ ਨਾਲ ਹੀ ਨਾਲ ਸਾਨੂੰ ਮੱਛਰ ਵੀ ਕੱਟਦੇ ਹਨ ਮੱਛਰ ਦੇ ਕੱਟਣ ਨਾਲ ਸਾਨੂੰ ਬਹੁਤ ਹੀ ਬਿ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਲਾਈਟ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਲਾਈਟ ਤੋਂ ਬਿਨਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਸਾਨੂੰ ਖਾਣਾ ਬਣਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਲਾਈਟ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ